ਹਾਂ ਇਹ ਬਿਲਕੁਲ ਸੱਚ ਹੈ ਕਿ ਕਿਰਾਏ ਦੀਆਂ ਬਾਈਕਾਂ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਹੀ ਲੋਕਪ੍ਰਿਅ ਹੋ ਗਈਆਂ ਹਨ ਇਹ ਇੱਕ ਸਹੂਲਤ ਭਰੀ ਆਰਥਿਕ ਅਤੇ ਵਾਤਾਵਰਨ ਮਿੱਤਰ ਵਿਕਲਪ ਹੈ ਜੋ ਕਿ ਟਰੈਫਿਕ ਪੈਟਰੋਲ ਦੀਆਂ ਵ ਵੱਧਦੀਆਂ ਕੀਮਤਾਂ ਅਤੇ ਆਵਾਜਾਈ ਦੀਆਂ ਸਮੱਸਿਆਵਾਂ ਦਾ ਇੱਕ ਵਧੀਆ ਹੱਲ ਪ੍ਰਦਾਨ ਕਰਦੀ ਹੈ ਜੇ ਅਸੀਂ ਆਧੁਨਿਕ ਸ਼ਹਿਰੀ ਜੀਵਨ ਨੂੰ ਵੇਖੀਏ ਤਾਂ ਅਸੀਂ ਪਾਵਾਂਗੇ ਕਿ ਕਈ ਵਿਦਿਆਰਥੀ ਦਫ਼ਤਰੀ ਕਰਮਚਾਰੀ ਅਤੇ ਯਾਤਰੀ ਹਮੇਸ਼ਾ ਆਵਾਜਾਈ ਦੀ ਵਧੀਆ ਢੰਗ ਦੀ ਤਲਾਸ਼ ਕਰਦੇ ਹਨ ਕਿਰਾਏ ਦੀਆਂ ਬਾਈਕਾਂ ਇਹਨਾਂ ਸਾਰੇ ਲੋਕਾਂ ਲਈ ਆਸਾਨੀ ਲਿਆਉਂਦੀਆਂ ਹਨ ਕਿਉਂਕਿ ਇਹ ਸਸਤੀਆਂ ਹੁੰਦੀਆਂ ਹਨ ਐਪ ਬੇਸਡ ਹੋ ਹੈਗੀਆਂ ਵਾ ਅਤੇ ਆਸਾਨੀ ਨਾਲ ਉਪਲੱਬਧ ਹੁੰਦੀਆਂ ਹਨ ਇਹ ਵਿਅਕਤੀਆਂ ਨੂੰ ਆਪਣੀ ਸਹੂਲਤ ਅਨੁਸਾਰ ਕਿਰਾਏ 'ਤੇ ਲੈਣ ਅਤੇ ਵਰਤਣ ਦੀ ਆਜ਼ਾਦੀ ਦਿੰਦੀਆਂ ਹਨ ਜਿਸ ਕਰਕੇ ਉਹ ਬਿਨਾਂ ਕਿਸੇ ਵਾਧੂ ਖਰਚੇ ਜਾਂ ਸਮੱਸਿਆ ਦੇ ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਹਨ ਇਸ ਦੇ ਨਕਾਰੀ ਪੱਖ ਵੀ ਹਨ ਜਾਂ ਨੁਕਸਾਨ ਵੀ ਹਨ ਜਿਵੇਂ ਕਿ ਕਈ ਵਾਰ ਇਹ ਉਪਲੱਬਧ ਨਹੀਂ ਹੁੰਦੀਆਂ ਬਹੁਤ ਜ਼ਿਆਦਾ ਭੀੜ ਕਰਕੇ ਇਹਨਾਂ ਦਾ ਮਿਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਸਾਰੇ ਬੰਦੇ ਇਦ ਇਸਦੀ ਭਾਲ ਵਿੱਚ ਰਹਿੰਦੇ ਹਨ ਅਤੇ ਕਈ ਕਰਕੇ ਭੀੜ ਜ਼ਿਆਦਾ ਹੋਣ ਕਰਕੇ ਸਾਨੂੰ ਉਪਲੱਬਧ ਨਹੀਂ ਹੁੰਦੀਆਂ ਜ਼ਿਆਦਾ ਵਰਤੋਂ ਕਰਨ ਤੋਂ ਬਾਅਦ ਇਹ ਬਾਈਕਾਂ ਦੀ ਹਾਲਤ ਠੀਕ ਨਹੀਂ ਰਹਿੰਦੀ ਜਾਂ ਇਹਨਾਂ ਨੂੰ ਰਿਪੇਅਰ ਦੀ ਲੋੜ ਪੈਂਦੀ ਹੈ ਉਸ ਕਰਕੇ ਵੀ ਬੰਦੇ ਨੂੰ ਥੋੜ੍ਹਾ ਜਿਹਾ ਇਹਦਾ ਨੁਕਸਾਨ ਝੱਲਣਾ ਪੈਂਦਾ ਹੈ ਅਤੇ ਇਹਦੀ ਹਾਲਤ ਠੀਕ ਨਹੀਂ ਰਹਿੰਦੀ ਅਤੇ ਕੁਝ ਥਾਵਾਂ 'ਤੇ ਇਹ ਚੋਰੀ ਵੀ ਹੋ ਸਕਦੀਆਂ ਹਨ ਜਾਂ ਤੋੜਫੋੜ ਦੀ ਸਮੱਸਿਆ ਵੀ ਹੁੰਦੀ ਹੈ ਕਿਉਂਕਿ ਇੱਕ ਬਾਈਕ ਨੂੰ ਚੋਰੀ ਕਰਨਾ ਬਹੁਤ ਆਸਾਨ ਹੈ ਪਰ ਇਹਨਾਂ ਸਮੱਸਿਆ ਦੇ ਬਾਵਜੂਦ ਇਹ ਭਵਿੱਖ ਲਈ ਇੱਕ ਵਧੀਆ ਵਿਕਲਪ ਹੈ ਕਿਉਂਕਿ ਮੈਂ ਮੰਨਦਾ ਹਾਂ ਕਿ ਉਹਨੂੰ ਭਵਿੱਖ ਵਿੱਚੋਂ ਵਾਤਾਵਰਨ ਪ੍ਰਦੂਸ਼ਣ ਅਤੇ ਗੱਡੀਆਂ ਦੀ ਵਧਦੀ ਗਿਣਤੀ ਨੂੰ ਅਗਰ ਵੇਖਿਆ ਜਾਵੇ ਤਾਂ ਇਹ ਸਾਡੇ ਲਈ ਇੱਕ ਸਭ ਤੋਂ ਵਧੀਆ ਸਲਿਊਸ਼ਨ ਹੈ ਇਹਦਾ ਮਤਲਬ ਇਸ ਪ੍ਰ ਪ੍ਰੋਬਲਮ ਦਾ ਸਭ ਤੋਂ ਵਧੀਆ ਸਲਿਊਸ਼ਨ ਹੈਗਾ ਵਾ ਇਹ ਵਾਲਾ ਕੁੱਲ ਮਿਲਾ ਕੇ ਕਿਰਾਏ ਦੀਆਂ ਬਾਈਕਾਂ ਇੱਕ ਨਵੀਨਤਮ ਅਤੇ ਆਧੁਨਿਕ ਯਾਤਰਾ ਵਿਧੀ ਹੈ ਜੋ ਕਿ ਵਾਤਾਵਰਨ ਲਈ ਲਾਭਦਾਇਕ ਹੈ ਅਤੇ ਆਰਥਿਕ ਤੌਰ 'ਤੇ ਕਿਫਾਇਤੀ ਅਤੇ ਅਸਾਨ ਵੀ ਹੈ ਇਸ ਨੂੰ ਕੋਈ ਵੀ ਬੱਚਾ ਬਜ਼ੁਰਗ ਵੱਡਾ ਛੋਟਾ ਕੋਈ ਵੀ ਚਲਾ ਸਕਦਾ ਹੈ ਅਤੇ ਬਹੁਤ ਹੀ ਮਤਲਬ ਪ ਪੈਸੇ ਦੀ ਮਤਲਬ ਯੂਸ ਜ਼ਿਆਦਾ ਯੂਜ਼ ਕੀਤੇ ਬਹੁਤ ਸਾਰੇ ਆਸਾਨੀ ਵਾਸਤੇ ਹੈ ਅਤੇ ਬਹੁਤ ਹੀ ਮਤਲਬ ਕਿਫਾਇਤੀ ਹੈ ਜਿਹਨੂੰ ਕਿਹਾ ਜਾ ਸਕਦਾ ਇਹ ਇੱਕ ਵਿਅਕਤੀਗਤ ਸਹੂਲਤ ਲ ਅਤੇ ਸਮਾਜਿਕ ਲਾਭ ਦੋਹਾਂ ਪੱਖਾਂ ਤੋਂ ਬਹੁਤ ਵਧੀਆ ਚੋਣ ਹੈਗੀ ਆ ਮੈਂ ਇਸ ਨੂੰ ਭਵਿੱਖ ਦੀ ਯਾਤਰਾ ਦੇ ਇੱਕ ਵਧੀਆ ਉਮੀਦ ਵਜੋਂ ਦੇਖਦਾ ਹਾਂ ਕਿ ਭਵਿੱਖ ਵਿੱਚ ਗੱਡੀਆਂ ਦੀ ਪੋਲਿਊਸ਼ਨ ਕਰਕੇ ਗੱਡੀਆਂ ਨੂੰ ਮਤਲਬ ਬੈਨ ਕੀਤਾ ਜਾਵੇ ਇੱਕ ਤਰ੍ਹਾਂ ਨਾਲ ਕਿਹਾ ਤਾਂ ਜਾ ਸਕਦਾ ਹੈ ਅਤੇ ਇਸ ਤਰ੍ਹਾਂ ਦੀ ਛੋਟੀ ਯਾਤਰਾਵਾਂ ਵਾਸਤੇ ਜਿੱਥੇ ਜ਼ਿਆਦਾ ਕਸ਼ਟ ਨਹੀਂ ਹੁੰਦਾ ਅਤੇ ਆਪਾਂ ਨੂੰ ਸਿਹਤ ਵਧੀਆ ਰਹਿੰਦੀ ਹੈ ਇਹਨਾਂ ਨਾਲ ਕਿਉਂਕਿ ਸਾਡੀ ਸਿਹਤ ਬਣਦੀ ਹੈ ਇਹਨਾਂ ਨਾਲ ਅਤੇ ਇਹਨਾਂ ਨੂੰ ਜ਼ਿਆਦਾ ਯੂਜ਼ ਕੀਤਾ ਜਾਵੇ ਅਤੇ ਮੈਂ ਇਹ ਦੇਖਦਾ ਕਿ ਬਸ ਫਿਊਚਰ ਵਿੱਚ ਆਪਾਂ ਨੂੰ ਥੋੜ੍ਹਾ ਜਿਹਾ ਇਹਦੀ ਜਾਗਰੂਕਤਾ ਵਧਾਉਣੀ ਪੈਣੀ ਆ ਅਤੇ ਆਪਾਂ ਨੂੰ ਇਸ ਬਾਈਕਾਂ ਨੂੰ ਯੂਜ਼ ਕਰਨਾ ਚਾਹੀਦਾ ਵਾ